ਹਾਂਜੀ ਮੈਨੂੰ ਕਈ ਵਾਰ ਪੰਜਾਬੀ ਵਿੱਚ ਅਨੁਵਾਦ ਕਰਨਾ ਪਿਆ ਸੀ ਮੈਂ ਅਨੁਵਾਦ ਪੰਜਾਬੀ ਬੋਲੀ ਲਿਖਾਈ ਲਿਖੀ ਅਤੇ ਸਮਝਣ ਵਿੱਚ ਮਦਦ ਨਹੀਂ ਹੁੰਦੀ ਸੀ ਮਦਦ ਕੀਤੀ ਸੀ ਕਿਸੀ ਨੇ ਅਨੁਵਾਦ ਦੀ ਮਦਦ ਨਾਲ ਮੈਂ ਆਪਨੇ ਵਿਚਾਰ ਅਤੇ ਜਵਾਬ ਪੰਜਾਬੀ ਭਾਸ਼ਾ ਵਿੱਚ ਵੀ ਦੇ ਸਕਦਾ ਹਾਂ ਜਦੋਂ ਵੀ ਕੋਈ ਵਿਸ਼ੇ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਗੱਲ ਹੁੰਦੀ ਹੈ ਤਾਂ ਉਹਨੂੰ ਸਮਝਣਾ ਅਤੇ ਅਨੁਵਾਦ ਕਰਨਾ ਮੇਰੇ ਲਈ ਇੱਕ ਮਿਹਨਤ ਵਾਲਾ ਕੰਮ ਹੁੰਦਾ ਹੈ ਮੈਂ ਮੇਰੀ ਜ਼ਿੰਦਗੀ ਵਿੱਚ ਇੱਕ ਵਾਰ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ ਮੈਂ ਇੱਕ ਆਰਟੀਕਲ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ ਜੋ ਕਿ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਗਿਆ ਸੀ ਇਸ ਅਨੁਵਾਦ ਦੇ ਦੌਰਾਨ ਮੈਂ ਮੁੱਖ ਵਿਚਾਰ ਅਤੇ ਭਾਸ਼ਾ ਦੀ ਸੋਚ ਸਮਝ ਨਾਲ ਪੰਜਾਬੀ ਨੂੰ ਵਧੀਆ ਤਰੀਕੇ ਨਾਲ ਸਮਝਿਆ ਇਹ ਮੇਰੇ ਲਈ ਬਹੁਤ ਮੁਸ਼ਕਿਲ ਵਾਲਾ ਕੰਮ ਸੀ ਪਰ ਮੈਂ ਪੰਜਾਬੀ ਨੂੰ ਫਿਰ ਵੀ ਵਧੀਆ ਤਰੀਕੇ ਨਾਲ ਅਨੁਵਾਦ ਕਰਕੇ ਵਿਖਾਇਆ ਸੀ ਅੰਗਰੇਜ਼ੀ ਭਾਸ਼ਾ ਤੋਂ